ਕਿਸੇ ਕਸਬੇ ਪਿੰਡ ਜਾਂ ਸ਼ਹਿਰ ਨੂੰ ਸਿਹਤ ਸੰਭਾਲ ਆਵਾਜਾਈ ਸਿੱਖਿਆ ਅਤੇ ਹੋਰ ਬੁਨਿਆਦੀ ਲੋੜਾਂ ਦੇ ਦ੍ਰਿਸ਼ਟੀਕੋਣ ਤੋਂ ਬਿਹਤਰ ਬਣਾਉਣ ਲਈ ਮੈਂ ਸਰਕਾਰ ਤੋਂ ਮਦਦ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ ਕਰਦੀ ਹਾਂ ਬਜ਼ੁਰਗਾਂ ਲਈ ਬਣਦੀ ਪੈਨਸ਼ਨ ਦੀ ਮੰਗ ਕਰਦੀ ਹਾਂ ਨਸ਼ਾ ਤਸਕਰ ਨੂੰ ਨੱਥ ਪਾਉਣ ਲਈ ਯੋਗ ਕਾਰਵਾਈ ਦੀ ਮੰਗ ਕਰਦੀ ਹਾਂ ਸਿਹਤ ਸੰਬੰਧੀ ਮਸਲਿਆਂ ਦੇ ਨਿਪਟਾਰੇ ਲਈ ਹਰੇਕ ਸ਼ਹਿਰ ਵਿੱਚ ਹਸਪਤਾਲ ਦੀ ਮੰਗ ਕਰਦੀ ਹਾਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕਾਲਜ ਅਤੇ ਸਕੂਲਾਂ ਦਾ ਨਿਰਮਾਣ ਕਰਵਾਉਣ ਦੀ ਮੰਗ ਕਰਦੀ ਹਾਂ